ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਵਿਆ ਅਰੋੜਾ ਹੈ ਮੈਂ ਨਾ ਇੱਕ ਕੈਬ ਬੁੱਕ ਕਰਵਾਈ ਸੀ ਸਰ ਹਾਂਜੀ ਮੈਂ ਐ ਐੱਨ ਆਰ ਆਈ ਕਲੋਨੀ ਲੁਹਾਰਕਾ ਰੋਡ ਤੋਂ ਏਅਰਪੋਰਟ ਤੱਕ ਦੀ ਕੈਬ ਬੁੱਕ ਕਰਵਾਈ ਸੀ ਤੁਹਾਡਾ ਡਰਾਈਵਰ ਨਾ ਹੀ ਮੇਰਾ ਫੋਨ ਚੁੱਕ ਰਿਹਾ ਅਤੇ ਨਾ ਹੀ ਉਹ ਹਜੇ ਤੱਕ ਆਇਆ ਤੁਸੀਂ ਮੈਨੂੰ ਦੇਖ ਕੇ ਦੱਸੋ ਕੀ ਪ੍ਰੋਬਲਮ ਹੈ ਸਰ ਮੇਰੀ ਫਲਾਈਟ ਹੈਗੀ ਹੈ ਅਤੇ ਮੇਰੀ ਫਲਾਈਟ ਡਿਲ ਡਿਲੇ ਹੋ ਜਾਣੀ ਮੇਰੀ ਫਲਾਈਟ ਮੈਂ ਚੜਨਾ ਆ ਮੈਨੂੰ ਕੰਮ ਹੈਗਾ ਹੈ ਅਤੇ ਇਹ ਕੋਈ ਤਰੀਕਾ ਨਹੀਂ ਹੋਇਆ ਨਾ ਤੁਹਾਡਾ ਡਰਾਈਵਰ ਮੈਨੂੰ ਫੋਨ ਚੁੱਕ ਰਿਹਾ ਨਾ ਮੈਨੂੰ ਕੋਈ ਰਿਸਪੋਂਸ ਕਰ ਰਿਹਾ ਪਲੀਜ਼ ਤੁਸੀਂ ਆਪਣਾ ਸਿਸਟਮ 'ਚ ਦੇਖ ਕੇ ਦੱਸੋ ਕਿਹੜਾ ਡਰਾਈਵਰ ਤੁਸੀਂ ਅਲਾਓਟ ਕੀਤਾ ਅਤੇ ਉਹ ਕਿੱਥੇ ਤੱਕ ਪਹੁੰਚਿਆ ਉਹ ਆ ਰਿਹਾ ਤਾਂ ਵੀ ਦੱਸ ਦਿਓ ਉਹ ਨਹੀਂ ਆ ਰਿਹਾ ਮੈਨੂੰ ਤਾਂ ਵੀ ਦੱਸ ਦਿਓ ਜੇ ਤੁਸੀਂ ਹੋਰ ਕੋਈ ਡਰਾਈਵਰ ਭੇਜਣਾ ਤਾਂ ਮੈਨੂੰ ਤਾਂ ਵੀ ਦੱਸੋ ਕਿਉਂਕਿ ਮੈਂ ਬੁੱਕ ਕਰਵਾਇਆ ਹੋਇਆ ਮੈਂ ਕੰਪਨੀ ਦੇ ਉੱਤੇ ਕੇਸ ਪਾ ਸਕਦੀ ਹਾਂ ਇਹ ਤਾਂ ਕਸਟਮਰ ਖ਼ਰਾਬ ਕਰਨ ਵਾਲੀ ਗੱਲ ਹੋਈ ਨਾ ਸਰ ਜਾਂ ਤਾਂ ਤੁਸੀਂ ਕੋਈ ਹੋਰ ਡਰਾਈਵਰ ਭੇਜ ਦਿਓ ਮੈਂ ਏਅਰਪੋਰਟ ਜਾਣਾ ਮੈਂ ਵੇਟ ਕਰਦੀ ਪਈ ਹਾਂ ਤੁਹਾਨੂੰ ਪਤਾ ਏਅ ਏਅਰਪੋਰਟ ਦੇ ਵਿੱਚ ਪਹਿਲੇ ਦੋ ਘੰਟੇ ਪਹਿਲੇ ਚੈਕਿੰਗ ਕਰਨੀ ਹੁੰਦੀ ਹੈ ਨਹੀਂ ਨਹੀਂ ਤੁਸੀਂ ਮੈਨੂੰ ਹੁਣੇ ਦੇਖ ਕੇ ਦੱਸੋ ਨਹੀਂ ਤਾਂ ਫਿਰ ਮੈਂ ਆਪਣਾ ਆਪਣੀ ਰਾਈਡ ਕੈਂਸਲ ਕਰੋ ਮੈਨੂੰ ਮੇਰਾ ਕੰਪਨਸੇਸ਼ਨ ਦੇਵੋ ਨਹੀਂ ਨਹੀਂ ਮੈਨੂੰ ਕੰਪਨਸੇਸ਼ਨ ਹੀ ਚਾਹੀਦਾ ਹੈ ਮੈਂ ਕਿਸੇ ਹੋਰ ਥਾਂ ਤੋਂ ਬੁੱਕ ਕਰਾ ਰਹੀ ਹਾਂ ਟੈਕਸੀ ਚਲੋ